ਮੈਂ ਨੇੜਲੇ ਪਿੰਡਾਂ ਦਾ ਦੌਰਾ ਕਰਨ ਲਈ ਕੁਝ ਕ ਖ਼ਾਸ ਉਦੇਸ਼ ਨੇ ਦਰਅਸਲ ਮੈਂ ਇੱਕ ਸ਼ਹਿਰ ਦਾ ਵਸਨੀਕ ਹਾਂ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਮਾਤਰਾ ਦਿਨੋ ਦਿਨ ਵਧਦੀ ਜਾ ਰਹੀ ਹੈ ਇਸ ਕਰਕੇ ਮੈਂ ਬਹੁਤ ਪਰੇਸ਼ਾਨ ਹਾਂ ਪ੍ਰਦੂਸ਼ਨ ਲਈ ਕਈ ਬਿਮਾਰੀਆਂ ਨੂੰ ਅੰਜਾਮ ਦੇਣ ਵਿੱਚ ਸਫ਼ਲ ਹੋ ਰਿਹਾ ਹੈ ਕੋਈ ਵੀ ਇਸ ਉੱਪਰ ਧਿਆਨ ਨਹੀਂ ਦੇ ਰਿਹਾ ਹਰ ਕੋਈ ਸਵਾਰਥੀ ਹੋ ਚੁੱਕਾ ਹੈ ਰੁੱਖਾਂ ਨੂੰ ਕੱਟ ਕੇ ਨਵੇਂ ਨਵੇਂ ਕਾਰਖਾਨੇ ਕੰਪਨੀਆਂ ਫੈਕਟਰੀਆਂ ਆਦਿ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਕਰਕੇ ਮੈਂ ਨੇੜਲੇ ਪਿੰਡਾਂ ਦਾ ਵਾਤਾਵਰਨ ਦੇਖਣ ਲਈ ਗਿਆ ਅਤੇ ਮੈਨੂੰ ਆਪਣੀ ਧਰਤੀ ਮਾਤਾ ਨਾਲ ਬਹੁਤ ਪਿਆਰ ਹੈ ਮੈਂ ਉੱਥੇ ਆਪਣੀ ਨਾਨੀ ਜੀ ਦੇ ਘਰ ਗਿਆ ਪਿੰਡਾਂ ਦੀ ਹਵਾ ਵਿੱਚ ਇੱਕ ਵੱਖਰਾ ਹੀ ਸਕੂਨ ਹੈ ਉੱਥੇ ਦੇ ਖੇਤ ਰੁੱਖ ਪਸ਼ੂ ਇੱਕ ਬਹੁਤ ਹੀ ਚੰਗਾ ਵਾਤਾਵਰਨ ਤਿਆਰ ਕਰਦੇ ਹਨ ਉੱਥੇ ਪ੍ਰਦੂਸ਼ਣ ਰਹਿਤ ਹਵਾ ਹੈ ਉੱਥੋਂ ਦੇ ਲੋਕ ਕਾਫੀ ਸਿਹਤਮੰਦ ਹਨ ਅਤੇ ਬਿਮਾਰੀਆਂ ਤੋਂ ਵੀ ਬਚੇ ਹੋਏ ਹਨ ਪਿੰਡਾਂ ਦੇ ਹਰ ਇੱਕ ਘਰ ਵਿੱਚ ਰੁੱਖ ਲਾਏ ਹੋਏ ਹਨ ਕਾਫੀ ਹਰਾ ਭਰਾ ਵਾਤਾਵਰਨ ਹੈ ਸ਼ਹਿਰਾਂ 'ਚ ਚਾਹੇ ਬਿਜਲੀ ਪਾਣੀ ਦੀ ਰਾਹਤ ਹੈ ਪਰ ਪਿੰਡਾਂ ਵਾਲਾ ਸਕੂਨ ਨਹੀਂ ਹੈ